ਅੱਜ ਗੱਲ ਕਰਾਂਗੇ ਕੁਝ ਆਸਾਨ ਆਸਨਾਂ ਦੀ ਜਿਹੜੇ ਕਿ ਭਾਵੇਂ ਕਰਨ ਨੂੰ ਉਨੇ ਮੁਸ਼ਕਿਲ ਨਹੀਂ ਹਨ ਪਰ ਹਨ ਬਹੁਤ ਅਸਰਦਾਰ ਸਾਡੇ ਸਰੀਰ ਅਤੇ ਦਿਮਾਗ ਨੂੰ ਸ਼ਾਂਤ ਕਰਨ ਦੇ ਨਾਲ ਸਾਡੇ ਸਰੀਰ ਨੂੰ ਬਲਵਾਨ ਬਣਾਉਣ ਵਿੱਚ ਇਹ ਆਸਨ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ ਤਾਂ ਵੇਖਦੇ ਹਨ ਕਿਹੜੇ ਇਹ ਹਨ ਆਸਨ ਅਤੇ ਇਹਨਾਂ ਦਾ ਕੀ ਕੀ ਲਾਭ ਹੁੰਦਾ ਹੈ ਵਜਰ ਆਸਨ ਦਿਮਾਗ ਨੂੰ ਸ਼ਾਂਤ ਕਰਦਾ ਹੈ ਪਾਚਨ ਕਿਰਿਆ ਠੀਕ ਕਰ ਕਰ ਕਬਜ਼ ਅਤੇ ਤੇਜ਼ਾਬ ਨੂੰ ਠੀਕ ਕਰਦਾ ਹੈ ਖਾਣਾ ਖਾਣ ਤੋਂ ਬਾਅਦ ਵੀ ਕੀਤਾ ਜਾ ਸਕਦਾ ਹੈ ਲੱਕ ਪੀੜ ਠੀਕ ਕਰਦਾ ਹੈ ਪਿਸ਼ਾਬ ਦੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ ਮੋਟਾਪਾ ਘਟਾ ਖੂਨ ਸੰਚਾਰ ਠੀਕ ਕਰਦਾ ਹੈ ਬੱਲ ਆਸਨ ਮੋਢੇ ਛਾਤੀ ਅਤੇ ਪਿੱਠ ਨੂੰ ਤਣਾਅ ਮੁਕਤ ਕਰਦਾ ਹੈ ਥਕਾਵਟ ਦੂਰ ਅਤੇ ਖੂਨ ਦਾ ਸੰਚਾਰ ਠੀਕ ਕਰਦਾ ਹੈ ਰੀੜ ਦੀ ਹੱਡੀ ਨੂੰ ਲਚਕੀਲਾ ਬਣਾਉਂਦਾ ਹੈ ਨਿਤੰਬ ਲੱਤਾਂ ਅਤੇ ਗਿੱਟਿਆਂ ਨੂੰ ਮਜ਼ਬੂਤ ਕਰਦਾ ਹੈ ਅਦਮੁੱਖ ਸਵਾਨ ਆਸਨ ਦਿਮਾਗ ਸ਼ਾਂਤ ਕਰਦਾ ਹੈ ਮੋਢਿਆਂ ਹੱਥਾਂ ਪੈਰਾਂ ਪੱਟਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਔਰਤਾਂ ਵਿੱਚ ਮਹਾਵਾਰੀ ਬੰਦ ਹੋਣ ਦੇ ਸਮੇਂ ਮਦਦ ਕਰਦਾ ਹੈ ਗਠੀਆ ਰੋਕਦਾ ਹੈ ਢਿੱਡ ਦੀਆਂ ਸਮੱਸਿਆਵਾਂ ਵੀ ਠੀਕ ਕਰਦਾ ਹੈ ਸਿਰ ਪੀੜ ਉਨੀਂਦਰਾ ਲੱਕ ਪੀੜ ਵੱਧ ਰਕਤ ਚਾਪ ਨੂੰ ਦੂਰ ਕਰਦਾ ਹੈ ਭੁਜੰਗ ਆਸਨ ਮੋਢੇ ਛਾਤੀ ਅਤੇ ਢਿੱਡ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਲੱਕ ਦੇ ਹੇਠਲੇ ਹਿੱਸੇ ਦੀ ਖਿੱਚ ਦੂਰ ਕਰਦਾ ਹੈ ਮੋਢੇ ਬਾਹਵਾਂ ਅਤੇ ਰੀੜ ਦੀ ਹੱਡੀ ਨੂੰ ਸੁਡੋਲ ਬਣਾਉਂਦਾ ਹੈ ਮਹਾਂਵਾਰੀ ਦੀ ਅਨਿਯਮਤਾ ਨੂੰ ਦੂਰ ਕਰਦਾ ਹੈ ਛਾਤੀ ਅਤੇ ਫੇਫੜਿਆਂ ਨੂੰ ਖੋਲ੍ਹਦਾ ਹੈ ਸਰੀਰ ਵਿੱਚ ਹਵਾ ਅਤੇ ਖੂਨ ਦਾ ਸੰਚਾਰ ਵਿੱਚ ਮਦਦ ਕਰਦਾ ਹੈ ਅਰਧ ਭੁਜੰਗ ਆਸਨ ਸਰੀਰ ਨੂੰ ਤਨਾਵ ਮੁਕਤ ਕਰਦਾ ਹੈ ਧਨੁਰ ਆਸਨ ਸਾਹ ਦੀਆਂ ਬਿਮਾਰੀਆਂ ਦਮਾ ਠੀਕ ਕਰਨ ਵਿੱਚ ਸਹਾਇਕ ਹੈ ਭੁੱਖ ਅਤੇ ਕਬਜ਼ ਦੋਵਾਂ ਨੂੰ ਠੀਕ ਕਰਕੇ ਪੇਟ ਦੀਆਂ ਬਿਮਾਰੀਆਂ ਦੂਰ ਕਰਦਾ ਹੈ ਸਰੀਰ ਵਿੱਚ ਖੂਨ ਸੰਚਾਰ ਠੀਕ ਕਰਕੇ ਤਣਾਅ ਮੁਕਤ ਕਰਦਾ ਹੈ ਗਊ ਮੁੱਖ ਆਸਨ ਵਰੀਕ ਸ਼ਾਹ ਆਸਨ ਸਰੀਰ ਨੂੰ ਸੁਡੋਲ ਬਣਾਉਂਦਾ ਹੈ ਸੇਤੂਬੰਧ ਆਸਨ ਧੋਣ ਛਾਤੀ ਰੀੜ ਦੀ ਹੱਡੀ ਅਤੇ ਨਿਤੰਬ ਨੂੰ ਮਤੁ ਮਜ਼ਬੂਤ ਕਰਦਾ ਹੈ ਨੌਕ ਆਸਨ ਪੇਟ ਦੀ ਚਰਬੀ ਦੂਰ ਕਰਦਾ ਹੈ ਮੱਤਸੀ ਆਸਨ ਲੱਕ ਨੂੰ ਪਤਲਾ ਤੇ ਲਚਕੀਲਾ ਬਣਾਉਂਦਾ ਹੈ ਫੇਫੜਿਆਂ ਦੀ ਸਫਾਈ ਕਰਦਾ ਹੈ ਸਿਰ ਚਕਰਾਉਣ ਧੁੰਨੀ ਠੀਕ ਕਰਦਾ ਹੈ ਸ਼ਵਾਸ ਆਸਨ ਸਾਰੇ ਸਰੀਰ ਨੂੰ ਸ਼ਾਂਤ ਰੱਖਦਾ ਹੈ ਬਲੱਡ ਪ੍ਰੈਸ਼ਰ ਠੀਕ ਕਰਦਾ ਹੈ ਧੰਨਵਾਦ